ਮੈਂ ਤੁਹਾਨੂੰ ਅੱਜ ਉਸ ਸਮੇਂ ਬਾਰੇ ਦੱਸਦੀ ਹਾਂ ਕਿ ਜਦੋਂ ਮੈਨੂੰ ਸਕੂਲ ਦੀ ਪਲੱਸ ਟੂ ਕੰਪਲੀਟ ਹੋਣ ਤੋਂ ਬਾਅਦ ਮੈਂ ਕੋਲਜ ਲੈਵਲ ਵਿੱਚ ਜਾਣਾ ਚਾਹੁੰਦੀ ਸੀ ਅਤੇ ਪਰ ਘਰ ਦੀ ਕੰਡੀਸ਼ਨ ਉਹੋ ਜਿਹੀ ਹੋਣ ਕਰਕੇ ਮੈਂ ਕੋਲਜ ਲੈਵਲ ਵਿੱਚ ਜਾ ਨਾ ਸਕੀ ਫਿਰ ਮੈਨੂੰ ਆਪਣੀ ਲਾਈਫ ਵਿੱਚ ਬੜਾ ਸਟਰਗਲ ਕਰਨਾ ਪਿਆ ਬਹੁਤ ਮਿਹਨਤ ਕਰਨੀ ਪਈ ਬਹੁਤ ਜ਼ਿਆਦਾ ਸਟਰਗਲ ਵਾਲੇ ਕੰਮ ਕਰਨੇ ਪਏ ਦਿਨੇ ਕਰਨੇ ਪਏ ਸ਼ਾਮੀ ਕਰਨੇ ਪਏ ਸਾਰਾ ਦਿਨ ਮਿਹਨਤ ਵਿੱਚ ਹੀ ਲੱਗੀ ਰਹਿਣਾ ਫਿਰ ਮੈਂ ਆਪਣੇ ਕੋਲਜ ਐਡਮਿਸ਼ਨ ਲਿਤੀ ਕੋਲਜ ਵਿੱਚ ਸਟੱਡੀ ਵੀ ਕੀਤੀ ਟਿਊਸ਼ਨਾਂ ਤੋਂ ਵਗੈਰ ਸਟੱਡੀ ਕੀਤੀ ਕਿ ਜਿਹਦੇ ਵਿੱਚ ਮੈਨੂੰ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਸਾਰੇ ਬੱਚਿਆਂ ਨੇ ਟਿਊਸ਼ਨਾਂ ਰੱਖੀਆਂ ਹੁੰਦੀਆਂ ਸੀ ਮੈਂ ਨਹੀਂ ਰੱਖੀਆਂ ਹੁੰਦੀਆਂ ਸੀ ਮੈਂ ਜੋ ਸਮਝਣਾ ਕੋਲਜ ਤੋਂ ਥੋੜ੍ਹਾ ਸਮਝਿਆ ਘਰ ਆਣ ਕੇ ਥੋੜ੍ਹਾ ਬਹੁਤਾ ਸਮਝਣਾ ਆਪਣੀ ਆਪਣਾ ਕੰਮ ਕੁੰਮ ਕਰਨਾ ਅਤੇ ਥੋੜ੍ਹੀ ਸਟੱਡੀ ਕਰਨੀ ਥੋੜ੍ਹੀ ਮਿਹਨਤ ਵੱਲ ਧਿਆਨ ਕਰਨਾ ਮਿਹਨਤ ਕਰਨੀ ਪੈਸੇ ਜੋੜਨੇ ਕੋਲਜ ਦੀਆਂ ਫੀਸਾਂ ਦੇਣੀਆਂ ਕਈ ਵਾਰੀ ਕਲਾ ਜਿਹੜੇ ਸਕੂਲ ਦੇ ਟੀਚਰ ਹੁੰਦੇ ਸੀ ਅਸਾਈਨਮੈਂਟ ਦੇਣ ਨੂੰ ਦਿੰਦੇ ਸੀ ਅਸਾਈਨਮੈਂਟ ਦਿੰਦੇ ਸੀ ਬਣਾਉਣ ਨੂੰ ਮੇਰੇ ਕੋਲ ਇੰਨਾ ਵੀ ਟਾਈਮ ਨਹੀਂ ਲੱਗਣਾ ਕਿ ਮੈਂ ਅਸਾਈਨਮੈਂਟ ਪੂਰੀ ਕਰ ਸਕਾਂ ਅਸਾਈਨਮੈਂਟ ਪੂਰੀ ਨਾ ਹੋਣ ਕਰਕੇ ਮੈਨੂੰ ਕਈ ਵਾਰੀ ਕਾਫੀ ਝਿੜਕਾਂ ਵੀ ਪੈਂਦੀਆਂ ਹੁੰਦੀਆਂ ਸੀ ਪਰ ਜਦੋਂ ਲਾਸਟ ਡੇਟ ਰਹਿ ਜਾਂਦੀ ਸੀ ਮੈਂ ਰਾਤੀਂ ਬਹਿ ਬਹਿ ਕੇ ਅਸਾਈਨਮੈਂਟਾਂ ਪੂਰੀਆਂ ਕਰਨੀਆਂ ਜਿਵੇਂ ਮਰਜ਼ੀ ਮੰਮਾ ਪਾਪਾ ਨੇ ਵੀ ਕਹਿਣਾ ਕਿ ਹਾਂਜੀ ਤੁਸੀਂ ਅਸਾਈਨਮੈਂਟ ਨਹੀਂ ਪੂਰੀ ਕੀਤੀ ਟੀਚਰ ਨੇ ਵੀ ਕਹਿਣਾ ਬਸ ਉਹਨਾਂ ਦੀਆਂ ਝਿੜਕਾ ਸੁਣ ਸੁਣ ਕੇ ਸੁਣ ਸੁਣ ਕੇ ਆਪਣੇ ਡੈਡ ਲਾਈਟ ਅਸਾਈਨਮੈਂਟ ਨੂੰ ਪੂਰਾ ਕਰਦੀ ਰਹੀ ਆਪਣੀ ਲਾਈਫ 'ਚ ਮਿਹਨਤ ਵੀ ਕਰਦੀ ਰਹੀ ਪੂਰੀਆਂ ਮਿਹਨਤਾਂ ਕਰ ਕਰ ਕੇ ਆਪਣੇ ਕੋਲਜ ਲੈਵਲ ਦੀ ਸਟੱਡੀ ਪੂਰੀ ਕੀਤੀ ਜੋ ਮੇਰਾ ਸੁਪਨਾ ਸੀ ਮੈਂ ਕੋਲਜ ਲੈਵਲ ਜਾਣਾ ਚਾਹੁੰਦੀ ਹਾਂ ਜਿਵੇਂ ਮਰਜ਼ੀ ਜਾਣਾ ਕਿ ਭਾਵੇਂ ਮੈਨੂੰ ਮਿਹਨਤ ਕਰਨੀ ਪਵੇ ਪਰ ਮੈਂ ਮਿਹਨਤ ਕੀਤੀ ਵੀ ਆਪਣੀ ਲਾਈਫ ਵਿੱਚ ਇਹ ਨਹੀਂ ਕਿ ਨਹੀਂ ਕੀਤੀ ਮਿਹਨਤ ਕੀਤੀ ਆਪਣੇ ਦਮ 'ਤੇ ਕੀਤੀ ਪੈਸੇ ਜੋੜੇ ਕੋਲਜ ਨੂੰ ਦਿੱਤੇ ਅਸਾਈਨਮੈਂਟਾਂ ਜਿਵੇਂ ਪੂਰੀਆਂ ਵੀ ਕੀਤੀਆਂ ਮਿਹਨਤ ਕਰ ਕਰਕੇ ਕੀਤੀਆਂ ਓਕੇ ਬਸ ਲਾਈਫ 'ਚ ਇਹੀ ਹੈ ਕਿਸ ਸਟਰਗਲ ਕਰ ਕਰਕੇ ਹੀ ਜ਼ਿੰਦਗੀ 'ਚ ਕੁਝ ਪ੍ਰਾਪਤ ਹੁੰਦਾ ਹੈ ਕਰਨਾ ਵੀ ਚਾਹੀਦਾ ਸਟਰਗਲ ਕਰਕੇ ਐਕਸਪੀਰੀਅੰਸ ਵੀ ਮਿਲਦਾ ਓਕੇ